ਮੇਰਾ ਪਸਿੰਦਾ ਪਸੰਦਿਦਾ ਅਭਿਨੇਤਾ ਵਿਧੂ ਜੋਂਬਾਲ ਹੈ ਜੋ ਕਿ ਮੈਨੂੰ ਬਹੁਤ ਵਧੀਆ ਲੱਗਦਾ ਏ ਉਹਦੀ ਫਿਜ਼ਿਕ ਮੈਨੂੰ ਬਹੁਤ ਵਧੀਆ ਲੱਗਦੀ ਹੈ ਵਿਧੂ ਜੋਂਬਾਲ ਦੀ ਉਹਦੀ ਬਹੁਤ ਵਧੀਆ ਮਸਕੂਲਰ ਬੋਡੀ ਹੈ ਐਕਸ਼ਨ ਮੈਨ ਹੈ ਕਿਹਾ ਜਾਂਦੇ ਨੇ ਬਹੁਤ ਵਧੀਆ ਹਜੇ ਵੀ ਫਿੱਟ ਹੈ ਚਾਲ੍ਹੀ ਸਾਲ ਹੋਣ ਦੇ ਬਾਵਜੂਦ ਵੀ ਬਹੁਤ ਫਿਟ ਹੈ ਬਾਡੀ ਬਹੁਤ ਵਧੀਆ ਫਿਜਿਕ ਬਹੁਤ ਵਧੀਆ ਹੈ ਜਿਸ ਕਰਕੇ ਮੈਨੂੰ ਉਹ ਬਹੁਤ ਵਧੀਆ ਲੱਗਦਾ ਏ ਉਹ ਬੰਦਾ ਡੋਨੇਟ ਵੀ ਵਧੀਆ ਕਰਦਾ ਏ ਗਰੀਬਾਂ ਦੀ ਬਹੁਤ ਮਦਦ ਕਰਦਾ ਐਨ ਡਾਊਨ ਟੂ ਅਰਥ ਬੰਦਾ ਹੈ ਉਹ ਅਤੇ ਅਭਿਨੇਤਰੀ ਮੈਨੂੰ ਕਟ ਕਟਰੀਨਾ ਕੈਫ ਵਧੀਆ ਲੱਗਦੀ ਹੈ ਜੋ ਕਿ ਬਹੁਤ ਵਧੀਆ ਏ ਇਹ ਵੀ ਇਹ ਵੀ ਮੈਨੂੰ ਇਸ ਕਰਕੇ ਵਧੀਆ ਲੱਗਦੀ ਏ ਕਿਉਂਕਿ ਇਹ ਨਾ ਡੋਨੇਟ ਬਹੁਤ ਵਧੀਆ ਕਰਦੇ ਨੇ ਇਹ ਡੋਨੇਟ ਕਰਕੇ ਵਧੀਆ ਲੱਗਦੇ ਨੇ ਜਿਨ ਗਰੀਬ ਬੰਦਿਆਂ ਨਾਲ ਵੀ ਬਹੁਤ ਵਧੀਆ ਚੰਗਾ ਵਿਵਹਾਰ ਏ ਇਹਨਾਂ ਦਾ ਕੋਵਿਡ ਕੋਵਿਡ ਵਿੱਚ ਬਹੁਤ ਬੰਦੇ ਪੈਸੇ ਡੋਨੇਟ ਕਰੇ ਅਤੇ ਇਹਨਾਂ ਨੇ ਗਰੀਬਾਂ ਲਈ ਰੋਟੀ ਰੂਟੀ ਖਵਾਈ ਹੈ ਇਸ ਇਸ ਕਰਕੇ ਮੈਨੂੰ ਵਧੀਆ ਲੱਗਦਾ ਐਕਟਿੰਗ ਵੀ ਇਹਨਾਂ ਦੀ ਵਧੀਆ ਹੈ ਅਭਿਨੇਤਰੀ ਐਕਟਿੰਗ ਬਹੁਤ ਵਧੀਆ ਕਰਦੀ ਹੈ ਕੈਟਰੀਨਾ ਕੈਫ ਡਾਂਸ ਵੀ ਵਧੀਆ ਲੱਗਦਾ ਹੈ ਅਤੇ ਵਿਧੂ ਜੋਂਬਾਲ ਦਾ ਐਕਸ਼ਨ ਬਹੁਤ ਵਧੀਆ ਲੱਗਦਾ ਹੈ ਮੈਨੂੰ ਇਸ ਕਰਕੇ ਮੈਨੂੰ ਵਿਧੂ ਜੋਂਬਾਲ ਅਤੇ ਕਟਰੀਨਾ ਕੈਫ ਦੋਨੇ ਪਸੰਦ ਨੇ